ਹੈਲੋ

ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਹਾਂਜੀ ਹਾਂਜੀ ਦੱਸੋ ਮੈਂ ਖਰੜ ਖੜ੍ਹਾਂ ਯਾਰ ਬਸ ਸਟੈਂਡ ਪਰ ਅੱਧਾ ਘੰਟਾ ਲੱਗ ਜਾਣਾ ਜਾਣ ਖਾਤਰ ਉੱਥੋਂ ਖਰੜ ਬਸ ਸਟੈਂਡ ਤੋਂ ਨਹੀਂ ਨਹੀਂ ਟ੍ਰੈਫਿਕ ਨਹੀਂ ਹੁੰਦੀ ਆਪਾਂ ਨੇ ਬ੍ਰਿਜ ਦੇ ਓਵਰਬ੍ਰਿਜ ਜਾਣਾ ਆਪਾਂ ਸੱਤਰ ਰੁਪਏ ਕਿਰਾਇਆ ਠੀਕ ਹੈ ਠੀਕ ਹੈ ਜੀ ਕੋਈ ਨਾ ਕੋਈ ਨਾ ਜਿਹੜਾ ਹੈਗਾ ਰੱਖ ਲਉਂਗੇ ਆ ਹਾਂਜੀ ਹਾਂਜੀ ਕੋਈ ਨਾ ਕੋਈ ਨਾ ਸਤਾਰ੍ਹਾਂ ਪੁਜਾ ਦੂੰਗਾ ਤੁਹਾਨੂੰ ਤੁਸੀਂ ਕਿੱਥੇ ਖੜ੍ਹੇ ਹੋ ਜੀ ਨਹੀਂ ਬੱਸ ਸਟੈਂਡ ਦੇ ਬਾਹਰ ਅੰਦਰ ਆਟੋ ਅਲਾਊ ਨਹੀਂ ਹੈਗੇ ਨਹੀਂ ਕੋਈ ਨਾ ਉਹ ਤਾਂ ਮੈਂ ਛੁਡਾ ਆਉਂਗਾ ਨਾਲ ਜਾ ਕੇ ਤੇਰੇ ਬੱਸ ਸਟੈਂਡ ਦੇ ਅੰਦਰ ਪਰ ਆਟੋ ਅੰਦਰ ਅਲਾਊਡ ਨਹੀਂ ਹੈਗੇ ਚਲਾਨ ਕਰ ਦਿੰਦੇ ਪੁਲਿਸ ਚੰਡੀਗੜ੍ਹ ਵਾਲੇ ਹਾਂਜੀ ਤੁਸੀਂ ਕਿੰਨੇ ਟਾਈਮ ਤੱਕ ਤਿਆਰ ਹੋਊਂਗੇ ਚਲੋ ਜਦੋਂ ਵੀ ਤੁਸੀਂ ਤਿਆਰ ਹੋ ਗਏ ਮੈਨੂੰ ਦੱਸ ਦਿਓ ਮੈਂ ਇੱਥੋਂ ਤੁਹਾਡੇ ਕੋਲ਼ ਆ ਜੂੰਗਾ ਉੱਥੋਂ ਲੈ ਕੇ ਤੁਹਾਨੂੰ ਛੱਡ ਆਊਗਾ ਬ ਸਤਾਰ੍ਹਾਂ ਬੱਸ ਸਟੈਂਡ ਉੱਤੇ ਹਾਂਜੀ ਹਾਂਜੀ ਚਲਦਾ ਜੀ ਤੁਸੀਂ ਮੈਨੂੰ ਇਸ ਉੱਤੇ ਹਲੋ ਹੈਲੋ ਕਰ ਦਿਓ ਹਾਂਜੀ ਹਾਂਜੀ ਉੱਥੋਂ ਮੈਂ ਨਾ ਪਿਕ ਕਰਕੇ ਤੁਹਾਨੂੰ ਪੁਜਾ ਦੂੰਗਾ ਟਾਈਮ ਸਿਰ ਹਾਂਜੀ ਟਾਈਮ ਨਾਲ ਦੱਸ ਮਿੰਟ ਤੱਕ ਦਸ ਮਿੰਟ 'ਚ ਪਹੁੰਚ ਜਾਊਂਗਾ ਤੁਹਾਡੇ ਕੋਲ ਨਹੀਂ ਕੋਈ ਨਾ ਟਾਈਮ ਸਿਰ ਪਹੁੰਚ ਜਾਊਂਗਾ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਮੈ ਤੁਹਾਨੂੰ ਟਾਈਮ ਸਿਰ ਤੁਹਾਨੂੰ ਪੁਜਾ ਦੂੰਗਾ ਸਵੇਰੇ ਓਕੇ ਠੀਕ ਹੈ ਜੀ ਓਕੇ